ਭੰਗੜੇ ਦੀ ਪਹਿਲਾਂ ਪੰਜਾਬ ਵਿੱਚ ਬਹੁਤ ਪ੍ਰਚਲਿਤ ਸੀ ਫਿਰ ਭੰਗੜਾ ਗੁਜਰਾਤ ਸਾਰੀਆਂ ਸਟੇਟਾਂ ਵਿੱਚ ਸਾਰੇ ਭਾਰ ਪ੍ਰਾਚੀਨ ਭਾਰਤ ਵਿੱਚ ਪਾਇਆ ਜਾਂਦਾ ਹੈ ਭੰਗੜਾ ਨਾਲ ਖੁਸ਼ੀ ਮਨਾਈ ਜਾਂਦੀ ਹੈ ਭੰਗੜਾ ਬਾਹਰਲੇ ਦੇਸ਼ਾਂ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਹਨ ਕਨੇਡਾ ਅਮੈਰੀਕਾ ਸਾਰੇ ਦੇਸ਼ਾਂ ਵਿੱਚ ਖੁਸ਼ੀ ਅਤੇ ਤਿਉਹਾਰਾਂ ਦੇ ਮੌਕੇ ਭੰਗੜਾ ਪਾਇਆ ਜਾਂਦਾ ਹੈ ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬੀਆਂ ਦਾ ਪਸੰਦ ਪਸੰਦੀਦਾ ਹੈ ਭੰਗੜੇ ਨੂੰ ਹਰੇਕ ਖੁਸ਼ੀ ਅਤੇ ਤਿਉਹਾਰ ਮੌਕੇ ਹੌਲੀ ਵੇਲੇ ਭੰਗੜਾ ਢੋਲ ਢਮੱਕੇ ਨਾਲ ਭੰਗੜਾ ਪਾਇਆ ਜਾਂਦਾ ਹੈ ਅਤੇ ਵਿਆਹ ਸ਼ਾਦੀਆਂ ਵਿੱਚ ਵੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਪੰਜਾਬ ਵਿੱਚ ਬਹੁਤ ਪ੍ਰਚਲਿਤ ਸੀ ਪੰਜਾਬ ਤੋਂ ਹੁਣ ਇਹ ਬਾਹਰਲੀਆਂ ਸਟੇਟਾਂ ਅਤੇ ਬਾਹਰਲੀਆਂ ਕੰਟਰੀਆਂ ਵਿੱਚ ਵੀ ਭੰਗੜਾ ਧੂਮਧਾਮ ਨਾਲ ਪਾਇਆ ਜਾਂਦਾ ਹੈ ਭੰਗੜਾ ਪਾਉਣ ਨਾਲ ਭੰਗੜੇ ਨਾਲ ਇੱਕ ਦੂਸਰੇ ਨਾਲ ਪਿਆਰ ਸਾਂਝਾ ਕੀਤਾ ਜਾਂਦਾ ਹੈ ਭੰਗੜਾ ਬਹੁਤ ਵਧੀਆ ਹੈ ਅਤੇ ਇਸ ਨਾਲ ਖੁਸ਼ੀ ਦੁੱਗਣੀ ਚੌਗੁਣੀ ਹੋ ਜਾਂਦੀ ਹੈ ਭੰਗੜਾ ਹਰੇਕ ਤਿਉਹਾਰ ਅਤੇ ਖੁਸ਼ੀ ਦੇ ਸਮੇਂ ਜ਼ਰੂਰੀ ਹੈ ਸਮਝਿਆ ਜਾਂਦਾ ਹੈ ਭੰਗੜਾ ਪਾਉਣ ਲਈ ਚਮਕ ਦਮਕ ਵਾਲੇ ਕੱਪੜਿਆਂ ਨੂੰ ਪਹਿਨਿਆ ਜਾਂਦਾ ਹੈ ਭੰਗੜੇ ਨਾਲ ਹਰੇਕ ਪ੍ਰੋਗਰਾਮ ਨੂੰ ਚਾਰ ਚੰਦ ਲੱਗ ਜਾਂਦੇ ਹਨ ਭੰਗੜਾ ਸਾਡੇ ਪੰਜਾਬ ਇਕੱਲੇ ਕੀ ਭੰਗੜੇ ਨਾਲ ਪੰਜਾਬੀ ਬਹੁਤ ਮਸ਼ਹੂਰ ਹਨ ਭੰਗੜਾ ਸਾਨੂੰ ਬਹੁਤ ਪਸੰਦ ਹੈ